ਹੈਲੋ ਹੈਲੋ ਹੈਲੋ ਹਾਂਜੀ ਸਰ ਮੈਂ ਊਸ਼ਾ ਪ੍ਰਾਸਕ ਮੀਡੀਆ ਤੋਂ ਰਾਹੁਲ ਕੁਮਾਰ ਬੋਲ ਰਿਹਾ ਹਾਂ ਸਰ ਸਾਡੇ ਅੱਜ ਦੇ ਸਾ ਸਰ ਸਾਡੇ ਅੱਜ ਦੇ ਚੈਨਲ ਵਿੱਚ ਮੀਡੀਆ ਦਾ ਇਹ ਸਵਾਲ ਹੈ ਕਿ ਸਾਡੇ ਦੇਸ਼ ਦੀ ਪੁਲਿਸ ਸਾਡੇ ਪੰਜਾਬ ਵਿੱਚ ਹੋ ਰਹੀ ਡਰੱਗ ਨਸ਼ੇ ਦੀ ਸਪਲਾਈ ਚੈਨਲ ਨੂੰ ਕਿਵੇਂ ਕੰਟਰੋਲ ਕਰ ਰਹੀ ਹੈ ਸਰ ਸਾਡੀ ਜਨਤਾ ਨੂੰ ਤੁਸੀਂ ਜਵਾਬ ਦੇਵੋ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਨਤਾ ਜਨਤਾ ਨੂੰ ਇਹ ਮੈਸੇਜ ਪਹੁੰਚਾਉਣ ਲਈ